ਖੇਤੀਬਾੜੀ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਤਾ ਹੈ ਖੇਤੀਬਾੜੀ ਦੇ ਵਿੱਚ ਜਿੰਨੇ ਵੀ ਘਰ ਦੇ ਪਰਿਵਾਰ ਦੇ ਜੀਅ ਹੁੰਦੇ ਹਨ ਤਨ ਮਨ ਧਨ ਦੇ ਨਾਲ ਕੰਮ ਕਰਦੇ ਹਨ ਅਤੇ ਚੰਗੀ ਖੇਤੀਬਾੜੀ ਕਰਦੇ ਹਨ ਜਿਨ੍ਹਾਂ ਦੇ ਨਾਲ ਆਪਣਾ ਵੀ ਪਿੰਡ ਦਾ ਵੀ ਅਤੇ ਸ਼ਹਿਰ ਦਾ ਵੀ ਇੱਥੋਂ ਤੱਕ ਦੇਸ਼ ਵਾਸਤੇ ਵੀ ਜ਼ਿਆਦਾ ਅੰਨ ਇਕੱਠਾ ਕੀਤਾ ਜਾਂਦਾ ਹੈ ਇਨ੍ਹਾਂ ਦੀ ਆਰਥਿਕ ਯੇ ਮ ਹਾਲਤ ਹੈ ਉਹ ਵੀ ਬਹੁਤ ਚੰਗੀ ਬਣ ਗਈ ਹੈ ਅਤੇ ਅੱਗੇ ਅੱਗੇ ਜਿਉਂ ਜਿਉਂ ਔਜਾਰ ਨਵੇਂ ਆ ਰਹੇ ਹਨ ਖੇਤੀਬਾੜੀ ਦਾ ਕੰਮ ਵੀ ਕਿਆ ਹੈ ਵੱਧ ਰਿਹਾ ਹੈ ਇਸ ਦੇ ਨਾਲ ਖੇਤੀਬਾੜੀ ਹੁਣ ਬਹੁਤ ਮਹੱਤਤਾ ਹੈ